ਜਿਹੜੀ ਖੇਤੀ ਆ ਉਹ ਇਸ ਤਰ੍ਹਾਂ ਬਦਲ ਗਈ ਆ ਪਹਿਲਾਂ ਜਿਹੜੀ ਖੇਤੀ ਸੀਗੀ ਉਹ ਪਸ਼ੂਆਂ ਦੇ ਨਾਲ ਕੀਤੀ ਜਾਂਦੀ ਸੀ ਪਹਿਲਾਂ ਫਸਲ ਦੀ ਬਿਜਾਈ ਅਤੇ ਕਟਾਈ ਪਸ਼ੂਆਂ ਨਾਲ ਹੁੰਦੀ ਸੀ ਪਸ਼ੂਆਂ ਨੂੰ ਹੱਲ ਨਾਲ ਜੋਇਆ ਜਾਂਦਾ ਸੀ ਹੱਥਾਂ ਨਾਲ ਖੇਤ ਵਾਹੇ ਜਾਂਦੇ ਸੀਗੇ ਫਿਰ ਫਸਲਾਂ ਦੀ ਕਟਾਈ ਵੀ ਹੱਥਾਂ ਨਾਲ ਕੀਤੀ ਜਾਂਦੀ ਸੀ ਅਤੇ ਜਿਹੜਾ ਫਸਲਾਂ ਨੂੰ ਪਾਣੀ ਦਿੱਤਾ ਜਾਂਦਾ ਸੀ ਉਹ ਵੀ ਪਸ਼ੂਆਂ ਨੂੰ ਜੋਤ ਕੇ ਖੂਹ ਦੇ ਨਾਲ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਅਤੇ ਫਿਰ ਫਸਲਾਂ ਨੂੰ ਪਾਣੀ ਦਿੱਤਾ ਜਾਂਦਾ ਸੀ ਪਰ ਜਿਹੜੀ ਹੁਣ ਖੇਤੀ ਦੇ ਵਿੱਚ ਬਦਲਾਅ ਆਇਆ ਹੈ ਉਸ ਉਹ ਹੈ ਮਸ਼ੀਨਰੀ ਯੁੱਗ ਜਿਹੜਾ ਹੁਣ ਚੱਲ ਰਿਹਾ ਹੈ ਹੁਣ ਕਾਫ਼ੀ ਹੱਦ ਤੱਕ ਟਰੈਕਟਰ ਆ ਗਏ ਨੇ ਮਸ਼ੀਨਾ ਆ ਗਈਆਂ ਨੇ ਜਿਸ ਦੇ ਨਾਲ ਖੇਤਾਂ ਦੀ ਜਿਹੜੀ ਬਿਜਾਈ ਹੈ ਕਟਾਈ ਹੈ ਉਹ ਟਰੈਕਟਰਾਂ ਨਾਲ ਮਸ਼ੀਨਾਂ ਨਾਲ ਹੁੰਦੀ ਹੈ ਅਤੇ ਟਿਊਬਵੈਲ ਵੀ ਨਵੇਂ ਟਿਊਬਵੈਲ ਵੀ ਘਰਾਂ ਘਰਾਂ ਵਿੱਚ ਲੱਗ ਗਏ ਹਨ ਟਿਊਬਵੈਲ ਦੇ ਨਾਲ ਜਮੀਨ ਦੇ ਹੇਠੋਂ ਪਾਣੀ ਕੱਢਿਆ ਜਾਂਦਾ ਹੈ ਅਤੇ ਉਹਨਾਂ ਦੇ ਨਾਲ ਜਿਹੜੀ ਹੈ ਸਿੰਚਾਈ ਕੀਤੀ ਜਾਂਦੀ ਹੈ ਅਤੇ ਫਸਲਾਂ ਟਰੈਕਟਰਾਂ ਦੇ ਨਾਲ ਖੇਤਾਂ ਨੂੰ ਵਾਹਿਆ ਜਾਂਦਾ ਹੈ ਫਿਰ ਮਸ਼ੀਨਾਂ ਦੇ ਨਾਲ ਉਹਨਾਂ ਨੂੰ ਬੀਜਿਆ ਜਾਂਦਾ ਹੈ ਫਿਰ ਮਸ਼ੀਨਾਂ ਦੇ ਨਾਲ ਉਹਨਾਂ ਨੂੰ ਕੱਟਿਆ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਮੰਡੀ ਦੇ ਵਿੱਚ ਟਰੈਕਟਰਾਂ ਦੁਆਰਾ ਹੀ ਟਰਾਲੀਆਂ ਦੇ ਵਿੱਚ ਲੱਦ ਕੇ ਸੁੱਟਿਆ ਜਾਂਦਾ ਹੈ ਮਤਲਬ ਵੇਚਿਆ ਜਾਂਦਾ ਵੇਚਿਆ ਜਾਂਦਾ ਫਿਰ ਟਿਊਬਵੈਲ ਜਿਹੜੇ ਕੇ ਜਮੀਨ ਦੇ ਹੋਠੋਂ ਪਾਣੀ ਕੱਢਦੇ ਆ ਉਹ ਖੇਤਾਂ ਦੇ ਸਿੰਚਾਈ ਲਈ ਵਰਤਿਆ ਜਾਂਦਾ ਹੈ ਪਹਿਲਾਂ ਲੋਕ ਜਿਹੜੇ ਸੀਗੇ ਹੱਥਾਂ ਦੇ ਨਾਲ ਪਾਣੀ ਹੈਡ ਪੰਪ ਨੂੰ ਗੇੜਦੇ ਸੀਗੇ ਅਤੇ ਪਾਣੀ ਕੱਢਦੇ ਸੀਗੇ ਹੁਣ ਟਿਊਬਵੈਲਾਂ ਰਾਹੀਂ ਹੀ ਸਾਰਾ ਕੰਮ ਕੀਤਾ ਜਾਂਦਾ ਹੁਣ ਬਿਜਲੀ ਅਤੇ ਮਸ਼ੀਨਰੀ ਯੁੱਗ ਹੈ ਇਸ ਕਰਕੇ ਹੁਣ ਖੇਤੀ ਦੇ ਵਿੱਚ ਬਹੁਤ ਸਾਰਾ ਬਹੁਤ ਜ਼ਿਆਦਾ ਬਦਲਾਅ ਆ ਚੁੱਕਾ ਹੈ